ਸਾਡੇ ਆਸ ਪਾਸ ਦੇ ਖੇਤਰ ਵਿੱਚ ਕੋਈ ਵੀ ਅ ਇੱਦਾਂ ਦੀ ਸੰਸਥਾ ਵੀ ਸੰਸਥਾ ਜਾਂ ਯੂਨੀਵਰਸਿਟੀ ਨਹੀਂ ਹੈ ਪਰ ਸਾਡੇ ਤੋਂ ਚਾਲੀ ਕਿਲੋਮੀਟਰ ਦੂਰ ਪਟਿਆਲੇ ਇੱਕ ਪੀ ਯੂ ਯੂਨੀਵਰਸਿਟੀ ਹੈ ਉਸ ਵਿੱਚ ਜਨਤਕ ਨਿੱਜੀ ਤਕਨੀਕੀ ਖੋਜ ਕਲਾ ਆਦਿ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਵਧੇਰੇ ਵਿਦਿਆਰਥੀ ਉੱਥੋਂ ਹੀ ਸਿਖਲਾਈ ਲੈਂਦੇ ਹਨ